ਹਾਂ ਅੱਜ ਪੇਂਡੂ ਖੇਤਰ ਵਿੱਚ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਸ਼ਹਿਰ ਦੇ ਵਿੱਚ ਜਾਣਾ ਚਾਹੁੰਦਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਹੁੰਦੀਆਂ ਹਨ ਪਿੰਡਾਂ ਦੇ ਵਿੱਚ ਸਹੂਲਤਾਂ ਨਹੀਂ ਹਨ ਜਿਵੇਂ ਕਿ ਕੋਈ ਵੀ ਹਰ ਇੱਕ ਚੀਜ਼ ਲੈਣ ਲਈ ਸ਼ਹਿਰ ਜਾਣਾ ਪੈਂਦਾ ਤਾਂ ਸ਼ਹਿਰ ਦੇ ਵਿੱਚ ਰਹਿ ਕੇ ਸਾਨੂੰ ਸ਼ਹਿਰ ਦੇ ਵਿੱਚ ਹੁਣ ਕੋਲੋਂ ਹੀ ਘਰ ਦੇ ਕੋਲੋਂ ਹੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜਿਵੇਂ ਕੋਈ ਐਮਰਜੈਂਸੀ ਹੋਸਪਿਟਲ ਜਾਣਾ ਹੋਵੇ ਤਾਂ ਵੀ ਸ਼ਹਿਰ ਦੇ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਕਿਤੇ ਦੂਰ ਜਾਣ ਲਈ ਯਾਤਰਾ ਕਰਨ ਲਈ ਜਾਣਾ ਹੋਵੇ ਤਾਂ ਸਾਨੂੰ ਸ਼ਹਿਰ ਦੇ ਵਿੱਚੋਂ ਹੀ ਬਸ ਮਿਲ ਜਾਂਦੀ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਸਹੂਲਤਾਂ ਹਨ ਅੱਜ ਦੇ ਟਾਈਮ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਸਹੂਲਤਾਂ ਹਨ ਤਾਂ ਕਿ ਪਿੰਡਾਂ ਦੇ ਵਿੱਚ ਇਹ ਸਹੂਲਤਾਂ ਨਹੀਂ ਹਨ ਜਿਸ ਕਾਰਨ ਹਰ ਇੱਕ ਇਨਸਾਨ ਸ਼ਹਿਰ ਦੇ ਵਿੱਚ ਜਾਣਾ ਚਾਹੁੰਦਾ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਸਮੱਸਿਆਵਾਂ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਹਰ ਇੱਕ ਇਨਸਾਨ ਸ਼ਹਿਰ ਦੇ ਵਿੱਚ ਜਾਣਾ ਚਾਹੁੰਦਾ ਹੈ ਜਿਸ ਕਾਰਨ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ